ਭਾਰਤ ਵਿੱਚ ਵੱਖ ਵੱਖ ਮੌਸਮ ਹੁੰਦੇ ਹਨ ਜਿਵੇਂ ਕਿ ਬਸੰਤ ਰੁੱਤ ਗਰਮੀਆਂ ਸਰਦੀਆਂ ਆਦਿ ਇਹ ਦੇਸ਼ ਵਿੱਚ ਵੱਖ ਵੱਖ ਖੇਤਰਾਂ ਵਿੱਚ ਵੱਖਰੇ ਹੁੰਦੇ ਹਨ ਜਿਵੇਂ ਕਿ ਕਸ਼ਮੀਰ ਵਿੱਚ ਬਰਫ ਪੈਂਦੀ ਹੈ ਅਤੇ ਕੇਰੇਲਾ ਵਿੱਚ ਗਰਮੀ ਹੁੰਦੀ ਹੈ ਅਤੇ ਸ਼੍ਰੀਨਗਰ ਵਿੱਚ ਵੀ ਬਰਫ ਪੈਂਦੀ ਹੈ ਅਤੇ ਚੀਰ ਪੂੰਜੀ ਵਿੱਚ ਮੀਂਹ ਹੀ ਵਰਦਾ ਰਹਿੰਦਾ ਹੈ ਅਤੇ ਪੰਜਾਬ ਵਿੱਚ ਗਰਮੀਆਂ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਅਤੇ ਸਰਦੀਆਂ ਵਿੱਚ ਬਹੁਤ ਜ਼ਿਆਦਾ ਸਰਦੀ ਹੁੰਦੀ ਹੈ ਦਿੱਲੀ ਵਿੱਚ ਵੀ ਇਹ ਜਾ ਹੀ ਮੌਸਮ ਹੈ ਮੁੰਬਈ ਵਿਚ ਨਾ ਜ਼ਿਆਦਾ ਗਰਮੀਆਂ ਹੁੰਦੀਆਂ ਹਨ ਅਤੇ ਨਾ ਜ਼ਿਆਦਾ ਸਰਦੀਆਂ ਉੱਥੋਂ ਦਾ ਮੌਸਮ ਇੱਕੋ ਜਿਹਾ ਰਹਿੰਦਾ ਹੈ ਇੱਦਾਂ ਹੀ ਦੇਸ਼ ਵਿੱਚ ਹਰ ਖੇਤਰਾਂ ਵਿੱਚ ਵੱਖ ਵੱਖ ਮੌਸਮ ਹੁੰਦੇ ਹਨ